ਨਮਸਕਾਰ ਭਾਅ ਜੀ ਤੁਸੀਂ ਭੁਪਿੰਦਰ ਟਰੈਵਲਰ ਤੋਂ ਬੋਲਦੇ ਹੋ ਨਾ ਜੀ ਹਾਂਜੀ ਭਾਅ ਜੀ ਮੈਂ ਤੁਹਾਡੀ ਕੈਬ ਬੁੱਕ ਕਰੀ ਸੀਗੀ ਜਲੰਧਰ ਤੋਂ ਯੂਨੀਵਰਸਿਟੀ ਜਾਣ ਲਈ ਮੇਰਾ ਐਗਜ਼ਾਮ ਸੀਗਾ ਜੀ ਹਾਂਜੀ ਕਿਉਂਕਿ ਮੈਂ ਪਹਿਲਾਂ ਹੀ ਬਹੁਤ ਲੇਟ ਹੋਇਆ ਹੋਇਆ ਸੀਗਾ ਜੀ ਅਤੇ ਡਰਾਈਵਰ ਵੀ ਬਹੁਤ ਚੰਗਾ ਸੀਗਾ ਹਾਂਜੀ ਮਿਲਣਹਾਰ ਵਰਤਣ ਸੀਗਾ ਜੀ ਹਾਂਜੀ ਭਾਅ ਜੀ ਤਾਂ ਭਾਅ ਜੀ ਤੁਸੀਂ ਉਹਨਾਂ ਦਾ ਕੋਈ ਕੰਟੈਕਟ ਨੰਬਰ ਦੇ ਸਕਦੇ ਹੋ ਤੁਸੀਂ ਕਿਉਂਕਿ ਕਿਉਂਕਿ ਕਾਰ ਦੇ ਵਿੱਚ ਮੇਰਾ ਮੋਬਾਈਲ ਰਹਿ ਗਿਆ ਸੀਗਾ ਜਾਂ ਤੁਸੀਂ ਉਹਦਾ ਅਡਰੈੱਸ ਅਤੇ ਮੈਨੂੰ ਆਹ ਵਾਲੇ ਨੰਬਰ 'ਤੇ ਸੈਂਡ ਕਰ ਦਿਉ ਕਿਉਂਕਿ ਉਹ ਵਾਲਾ ਨੰਬਰ ਤਾਂ ਤੁਹਾਨੂੰ ਪਤਾ ਹੀ ਹੈ ਉਹ ਮੋਬਾਈਲ ਦੇ ਵਿੱਚ ਹੀ ਹੈ ਹਾਂਜੀ ਭਾਅ ਜੀ ਚਲੋ ਠੀਕ ਆ ਭਾਅ ਜੀ ਧੰਨਵਾਦ ਜੀ ਤੁਹਾਡਾ ਬਹੁਤ